ਮੈਂ ਚਿੱਤਰਕਾਰੀ ਬਚਪਨ ਤੋਂ ਕਰਦੀ ਆ ਰਹੀ ਹਾਂ ਮੈਂ ਪਹਿਲਾਂ ਪੈਨਸਿਲ ਤੋਂ ਬਣਾ ਚਿੱਤਰਕਾਰੀ ਬਣਾਉਣੀ ਸਿੱਖੀ ਉਸਦੇ ਬਾਅਦ 'ਚ ਪੈਨਸਿਲ ਸਕੈੱਚ ਆਏ ਜਿਨ੍ਹਾਂ ਨਾਲ਼ ਮੈਂ ਚਿੱਤਰਕਾਰੀ ਬਣਾਉਣੀ ਸ਼ੁਰੂ ਕੀਤੀ ਅਤੇ ਉਸ ਉਸ ਤੋਂ ਬਾਅਦ ਫਿਰ ਮੈਂ ਮੋਮੀ ਸਕੈੱਚ ਬਣਾ ਨਾਲ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਅਤੇ ਇਹਨਾਂ ਸਭ ਨਾਲ਼ ਮੇਰੀ ਚਿੱਤਰਕਾਰੀ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਵੀ ਜਦੋਂ ਪੇ ਕਲਰ ਕਲਰ ਸਕੈੱਚ ਕਲਰ ਵਾਲੀ ਰੰਗਦਾਰ ਹੁੰ ਸਕੈੱਚ ਆਉਂਦੀ ਸੀ ਤਾਂ ਉਹਦੇ ਨਾਲ਼ ਮੇਰੀ ਪੇਂਟਿੰਗ ਖਰਾਬ ਹੋ ਜਾਂਦੀ ਸੀ ਜਿਸ ਦੇ ਨਾਲ਼ ਮੇਰੀ ਮੈਨੂੰ ਬਹੁਤ ਜ਼ਿਆਦਾ ਮੇਰੀਆਂ ਪੇਂਟਿੰਗਾਂ ਬਹੁਤ ਜ਼ਿਆਦਾ ਖਰਾਬ ਹੋਈਆਂ ਅਤੇ ਮੈਂ ਫਿਰ ਵੀ ਮੈਂ ਪੇਂਟਿੰਗ ਬਣਾਉਣ ਵਿੱਚ ਅਭਿਆਸ ਕਰਦੀ ਰਹੀ ਅਤੇ ਇੱਕ ਸਾਲ ਬਾਅਦ ਮੇਰੀ ਪੇਂਟਿੰਗ ਬਹੁਤ ਜ਼ਿਆਦਾ ਬਣਾ ਕਲਰ ਸਕੈੱਚ ਨਾਲ ਬ ਬਣਨੀ ਸ਼ੁਰੂ ਹੋ ਗਈ ਅਤੇ ਮੈਂ ਬਹੁਤ ਜ਼ਿਆਦਾ ਵਧੀਆ ਪੇਂਟਿੰਗਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਜਿਸ ਅਤੇ ਹੁਣ ਹੁਣ ਅੱਜ ਦੇ ਸ ਟਾਈਮ 'ਚ ਮੈਂ ਪੇਂਟਿੰਗਸ ਬਣਾਉਂਦੀ ਵੀ ਹਾਂ ਅਤੇ ਸਿਖਾਉਂਦੀ ਵੀ ਹਾਂ ਅਤੇ ਮੇਰੀ ਬਣਾਈ ਪੇਂਟਿੰਗ ਨੂੰ ਸਿੱਖ ਕੇ ਸਭ ਬਹੁਤ ਖੁਸ਼ ਹੁੰਦੇ ਹਨ ਅਤੇ ਮੈਨੂੰ ਇਹ ਪੇਂਟਿੰਗ ਬਣਾਈ ਮ ਬਣਾਉਣਾ ਸਿਖਾ ਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤਾਂ ਜੋ ਦੂਸਰਿਆਂ ਨੂੰ ਪ ਪੇਂਟਿੰਗ ਬਣਾ ਕੇ ਮ ਬਹੁਤ ਜ਼ਿਆਦਾ ਵਧੀਆ ਲੱਗ ਸਕੇ ਅਤੇ ਉਹ ਬਹੁਤ ਜ਼ਿਆਦਾ ਖੁਸ਼ ਪ੍ਰਾਪਤ ਕਰ ਖੁਸ਼ੀ ਪ੍ਰਾਪਤ ਕਰ ਸਕਣ ਦੇ ਪੇਂਟਿੰਗ ਬਹੁਤ ਜ਼ਿਆਦਾ ਵਧੀਆ ਕਲਾ ਹੁੰਦੀ ਹੈ